ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਸਰ ਐਮਾਜ਼ੋਨ ਤੋਂ ਗੱਲ ਕਰ ਰਹੇ ਹੋ ਹਾਂ ਸਰ ਜੀ ਮੈਂ ਤੁਹਾਨੂੰ ਇੱਕ ਪ੍ਰੋਡਕਟ ਦੇ ਰਿਗਾਰਡਿੰਗ ਕਾਲ ਕੀਤੀ ਸੀਗੀ ਹਾਂਜੀ ਮੈਂ ਤੁਹਾਨੂੰ ਮੈਂ ਤੁਹਾਡੀ ਸਾਈਟ ਦੇ ਉੱਪਰੋਂ ਨਾ ਬੁੱਕ ਮੰਗਵਾਈ ਸੀ ਇੱਕ ਕੰਪਟੀਸ਼ਨ ਇਗਜ਼ਾਮ ਦੀ ਕਿਰਨ ਪਬਲੀਕੇਸ਼ਨ ਦੀ ਬੁੱਕ ਸੀਗੀ ਅਤੇ ਉਹ ਜਿੱਦਾਂ ਕਿ ਉਹ ਜਿੱਦਾਂ ਸਾਈਟ 'ਤੇ ਪਾਈ ਸੀਗੀ ਨਾ ਜਿਹੜੇ ਵਿਊ ਨਾਲ ਸਾਈਟ 'ਤੇ ਪਾਈ ਸੀਗੀ ਅਤੇ ਉੱਦਾਂ ਹੀ ਬੁੱਕ ਮੇਰੇ ਕੋਲ ਉਹ ਪਹੁੰਚ ਚੁੱਕੀ ਹੈਗੀ ਅਤੇ ਜਦੋਂ ਮੈਂ ਬੁੱਕ ਦੇਖੀ ਮੇਰਾ ਆਰਡਰ ਲੈ ਕੇ ਆਇਆ ਡਿਲੀਵਰੀਮੈਨ ਜੀ ਤਾਂ ਉਹਦੀ ਪੈਕਿੰਗ ਬਹੁਤ ਹੀ ਵਧੀਆ ਕੀਤੀ ਹੋਈ ਸੀਗੀ ਜੀ ਕਿਤੋਂ ਵੀ ਲੱਗ ਨਹੀਂ ਰਿਹਾ ਸੀਗਾ ਵੀ ਵੀ ਇਹ ਕਿਤੋਂ ਮਤਲਬ ਬਾਹਰੋਂ ਪੈਕਿੰਗ ਹੋਈ ਵੀ ਹੈਗੀ ਉਹ ਸਿੱਧਾ ਸਿੱਧਾ ਸਪਸ਼ਟ ਦਿਖਾਈ ਦੇ ਰਿਹਾ ਸੀਗਾ ਵੀ ਇਹ ਸਿੱਧੇ ਕੰਪਨੀ 'ਚ ਪੈਕਿੰਗ ਹੋ ਕੇ ਆਈ ਆ ਉਸ ਤੋਂ ਬਾਅਦ ਜਦੋਂ ਮੈਂ ਬੁੱਕ ਖੋਲ੍ਹੀ ਹੈ ਜੀ ਅੰਦਰੋਂ ਉਹ ਅਤੇ ਉਹਦੇ ਵਿੱਚ ਜੋ ਜੋ ਸਾਈਟ ਦੇ ਉੱਪਰ ਲਿਖ ਰੱਖਿਆ ਸੀਗਾ ਐਮਾਜੋਨ ਦੀ ਸਾਈਟ ਉੱਪਰ ਵੀ ਬੁੱਕ ਦੇ ਆਹ ਚੀਜ਼ਾਂ ਹੈਗੀਆਂ ਉਹ ਬਿਲਕੁਲ ਸੇਮ ਡਿਟੋ ਨੇ ਜੀ ਕੋਈ ਇੱਕ ਪਰਸੈਂਟ ਦੀ ਵੀ ਕਹਿ ਦਈਏ ਆਪਣੀ ਸ਼ਿਕਾਇਤ ਨਹੀਂ ਹੈਗੀ ਵਿੱਚ ਉਹਦੇ ਥਿਊਰੀਜ ਵੀ ਨੇ ਬੁੱਕ ਦੇ ਕੁਆਸ਼ਚਨ ਕੁਆਸ਼ਚਨ ਵੀ ਨੇ ਟੈਸਟ ਵੀ ਨੇ ਮ ਕਿ ਬੁੱਕ ਦੇ ਵਿੱਚ ਅਤੇ ਉਹਦਾ ਜਿਹੜਾ ਪੇਪਰ ਆ ਜੀ ਉਹ ਤਾਂ ਬਹੁਤ ਹੀ ਵਧੀਆ ਕੁਆਲਟੀ ਦਾ ਪੇਪਰ ਹੈਗਾ ਉਹਦੇ ਵਿੱਚ ਕੋਈ ਇੱਕ ਪਰਸੈਂਟ ਵੀ ਕਿਤਾਬ 'ਚ ਨੁਕਸ ਹੈ ਨਹੀਂ ਗਾ ਅਤੇ ਉਹਦੇ ਰਿਗਾਰਡਿੰਗ ਮੈਂ ਤੁਹਾਨੂੰ ਕਾਲ ਕੀਤੀ ਸਰ ਬਹੁਤ ਧੰਨਵਾਦ ਹੈ ਜੀ ਵੀ ਜੋ ਕਿ ਤੁਸੀਂ ਕਸਟਮਰ ਦੇ ਵਿਸ਼ਵਾਸ 'ਤੇ ਖਰੇ ਉਤਰੇ ਹੋਗੇ ਜਿੱਦਾਂ ਤੁਹਾਡੇ ਵਿਸ਼ਵਾਸ ਕੀਤਾ ਸੀਗਾ ਸੇਮ ਮੈਨੂੰ ਉੱਦਾਂ ਚੀਜ਼ ਮਿਲੀ ਹੈ ਜੀ ਬਹੁਤ ਧੰਨਵਾਦ ਤੁਹਾਡਾ ਜੀ